ਹੈਲੋ ਹਾਂਜੀ ਹੈਲੋ ਹੂ ਇਜ਼ ਦੇਅਰ ਕੌਣ ਹੈ ਉਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਮਨੋਵਿਗਿਆਨੀ ਬੋਲ ਰਿਹਾਂ ਜੀ ਹਾਂਜੀ ਕੀ ਕੀ ਕੀ ਇਸ਼ੂ 'ਤੇ ਕਿਹੜੇ ਮੁੱਦੇ 'ਤੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੁਹਾਡੀ ਜਿਹੜੀ ਸਮੱਸਿਆ ਨੂੰ ਸੁਣ ਕੇ ਮੈਨੂੰ ਲੱਗ ਰਿਹਾ ਕਿ ਇਹਦੇ ਹੱਲ ਲਈ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੋਏਗਾ ਕਿ ਤੁਹਾਡਾ ਜਿਹੜਾ ਜਿਹੜੀ ਜੋ ਤੁਸੀਂ ਦਿਨ ਦੇ ਵਿੱਚ ਜਿਹੜੀ ਤੁਹਾਡਾ ਸਮਾਬੱਧ ਕੀਤਾ ਹੋਇਆ ਤੁਸੀਂ ਸਾਰੇ ਦਿਨ ਨੂੰ ਉਹਦੇ ਵਿੱਚ ਕਿਹੜੀ ਕਿਹੜੀਆਂ ਤੁਸੀਂ ਗਤੀਵਿਧੀਆ ਸ਼ਾਮਿਲ ਕੀਤੀਆਂ ਹੋਈਆਂ ਨੇ ਭਾਵ ਕਿ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਹੈ ਸੌਣ ਤੱਕ ਉਹ ਤੁਹਾਡੀ ਗਤੀਵਿਧੀਆਂ ਦੇ ਵਿੱਚ ਮੁੱਖ ਤੌਰ 'ਤੇ ਕੀ ਕੀ ਸ਼ਾਮਿਲ ਹੁੰਦਾ ਦੇਖੋ ਮਨੋਵਿਗਿਆਨੀ ਦੇ ਤੌਰ 'ਤੇ ਜਿਹੜਾ ਇੱਕ ਬਹੁਤ ਅਹਿਮ ਪੱਖ ਸਭ ਲਈ ਇਕੱਲੇ ਤੁਹਾਡੇ ਲਈ ਨਹੀਂ ਸਭ ਲਈ ਜਾਨਣਾ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਨਿਯਮਬੱਧ ਕਰਨਾ ਸਮਾਬੱਧ ਕਰਨਾ ਬੇਹੱਦ ਜ਼ਰੂਰੀ ਹੁੰਦਾ ਜਦੋਂ ਅਸੀਂ ਠੀਕ ਹੈ ਕਦੇ ਕਦਾਈ ਜਦੋਂ ਅਸੀਂ ਕੋਈ ਵੇਹਲ ਦਾ ਆਨੰਦ ਲੈਣਾ ਹੁੰਦਾ ਉਹ ਠੀਕ ਹੈ ਕਿ ਕੋਈ ਸਮਾਂ ਹੁੰਦਾ ਪੰਦਰ੍ਹਾਂ ਵੀਹ ਮਿੰਟ ਅੱਧਾ ਘੰਟਾ ਹੱਦ ਇੱਕ ਘੰਟਾ ਉਹ ਵੀ ਦਿਨ 'ਚ ਕਿਸੇ ਵੀ ਵੇਲੇ ਉਸ ਤੋਂ ਜ਼ਿਆਦਾ ਜਦੋਂ ਅਸੀਂ ਆਪਣੇ ਆਪ ਨੂੰ ਸਮੇਂ ਤੋਂ ਬਾਹਰ ਰੱਖ ਕੇ ਕਿਸੇ ਵੀ ਮਰਿਆਦਾ ਤੋਂ ਬਾਹਰ ਰੱਖ ਕੇ ਸਮੇਂ 'ਚ ਜ਼ਿਆਦਾ ਵਿਚਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਇਦਾਂ ਦੀ ਜਿਹੜੀਆਂ ਸਮੱਸਿਆਵਾਂ ਤੁਸੀਂ ਹੁਣ ਸ਼ੇਅਰ ਕੀਤੀਆਂ ਸਾਂਝੀਆਂ ਕੀਤੀਆਂ ਉਹ ਆਉਣੀਆਂ ਸੁਭਾਵਿਕ ਨੇ ਹੁਣ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਉੱਠਣਾ ਚਾਹੁੰਦੇ ਹੋ ਸਵੇਰੇ ਅੰਮ੍ਰਿਤ ਵੇਲੇ ਅਤੇ ਉਸ ਤੋਂ ਬਾਅਦ ਤੁਸੀਂ ਕਸਰਤ ਕਰਕੇ ਜਾਂ ਵੇਆਮ ਜੀਹਨੂੰ ਹਿੰਦੀ ਦੇ ਵਿੱਚ ਕਿਹਾ ਜਾਂਦਾ ਕਿ ਉਹ ਕਰਕੇ ਅਤੇ ਆਪਣਾ ਸ਼ੁਰੂਆਤ ਕਰਨੀ ਚਾਹੁੰਦੇ ਹੋ ਪਰ ਨਹੀਂ ਬਣ ਪਾਉਂਦਾ ਉਹਦੇ ਲਈ ਇੱਕ ਮਨੋਵਿਗਿਆਨੀ ਇੱਕ ਜਿਹੜਾ ਇੱਕ ਪੱਖ ਹੈ ਕਿ ਤੁਸੀਂ ਕੋਈ ਵੀ ਜਿਹੜੀ ਆਦਤ ਹੈ ਉਹਨੂੰ ਪਕਾਉਣਾ ਚਾਹੁੰਦੇ ਹੋ ਤਾਂ ਲਗਾਤਾਰ ਉਹਨੂੰ ਘੱਟੋ ਘੱਟ ਜਿਹੜਾ ਹੈ ਉਹ ਮਹੀਨਾ ਸਵਾ ਮਹੀਨਾ ਉਹਨੂੰ ਲਗਾਤਾਰ ਕਰੋ ਤਾਂ ਕਿ ਤੁਸੀਂ ਉਹ ਨਿਯਮ ਦੇ ਵਿੱਚ ਬੱਝ ਜਾਓ ਅਤੇ ਤੁਹਾਡੀ ਉਹ ਜਿਹੜੀ ਕਿਰਿਆ ਹੈ ਉਹ ਨਿਤ ਦੀ ਕਿਰਿਆ ਬਣ ਜਾਵੇ ਸੋ ਚਾਹੇ ਉਹ ਕਸਰਤ ਕਰਨਾ ਹੈ ਅੱਛਾ ਹੁਣ ਜਿਹੜੀ ਤੁਸੀਂ ਸਮੱਸਿਆ ਦੱਸੀ ਕਿ ਮਨ ਦਾ ਭਾਰਾ ਲੱਗਣਾ ਜਿਹਨੂੰ ਅੰਗਰੇਜ਼ੀ 'ਚ ਸਟਰੈਸ ਵੀ ਕਹਿ ਦਿੰਦੇ ਆ ਅਸੀਂ ਅਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਮਹਿਸੂਸ ਹੋਣੀਆਂ ਉਹਦਾ ਕਾਰਨ ਇੱਕ ਵੱਡਾ ਇਹ ਵੀ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਨਿਯਮਬੱਧ ਨਹੀਂ ਕਰਦੇ ਅਸੀਂ ਆਪਣਾ ਸਮਾਬੱਧ ਨਹੀਂ ਕਰਦੇ ਕਿਸੇ ਅਨੁਸ਼ਾਸਨ ਦੇ ਵਿੱਚ ਨਹੀਂ ਆਉਂਦੇ ਤਾਂ ਇਹ ਕੁਦਰਤੀ ਹੈ ਕਿ ਸਾਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨੂੰ ਪ੍ਰਪੱਖ ਕਰਨ ਲਈ ਤੁਸੀਂ ਜਿਹੜਾ ਹੈ ਉਹ ਜ਼ਰੂਰ ਜਿਹੜਾ ਹੈ ਉਹ ਮਹੀਨਾ ਤੋਂ ਸਵਾ ਮਹੀਨਾ ਉਸੇ ਰੂਟੀਨ ਨੂੰ ਉਸੇ ਜੋ ਤੁਹਾਡੀ ਦਿਨ ਦੀ ਜੋ ਗਤੀਵਿਧੀ ਹੈ ਉਹਨੂੰ ਸਮਾਬੱਧ ਕਰਕੇ ਅੱਗੇ ਚੱਲੋ ਤਾਂ ਕਿ ਤੁਹਾਨੂੰ ਜਿਹੜਾ ਹੈ ਉਹਦਾ ਲਾਹਾ ਮਿਲਣ ਲੱਗ ਜਾਵੇ ਚਾਹੇ ਉਹ ਕਸਰਤ ਕਰਨਾ ਹੈ ਚਾਹੇ ਉਹ ਗੁਰਬਾਣੀ ਨ ਨਿਤਨੇਮ ਕਰਨਾ ਹੈ ਅਤੇ ਚਾਹੇ ਉਹ ਤੁਹਾਡੀ ਕੋਈ ਪੜ੍ਹਾਈ ਕਰਨੀ ਹੈ ਜਾਂ ਲਾਈਬ੍ਰੇਰੀ ਜਾ ਕੇ ਉੱਥੇ ਜਾ ਕੇ ਕੋਈ ਸਮਾਂ ਬਿਤਾ ਕੇ ਉਥੇ ਕੋਈ ਇਦਾਂ ਦਾ ਸਮਾਬੱਧ ਤਰੀਕੇ ਨਾਲ ਉਥੇ ਆਪਣਾ ਸਮਾਂ ਬਿਤਾਉਣਾ ਅਤੇ ਉਹ ਉਹ ਉਹ ਬਹੁਤ ਜ਼ਰੂਰੀ ਚੀਜ਼ਾਂ ਨੇ ਸੋ ਉਮੀਦ ਕਰਦਾ ਕਿ ਤੁਸੀਂ ਜਿਹੜਾ ਹੈ ਇਹ ਗੱਲਾਂ ਫੋਲੋ ਕਰੋਂਗੇ ਅਤੇ ਇਹਦੇ ਨਾਲ ਤੁਹਾਨੂੰ ਲਾਹਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ